ਮੇਰੇ ਕੋਲੇ ਸਾਰਿਆਂ ਨਾਲੋਂ ਪਹਿਲਾਂ ਹੀਰੋ ਹੰਡਾ ਸਪਲੈਂਡਰ ਦੀ ਬਾਈਕ ਸੀ ਹੁਣ ਮੇਰੇ ਕੋਲ ਤਿੰਨ ਬਾਈਕਾਂ ਨੇ ਇੱਕ ਰੋਇਲ ਇੰਨਫੀਲਡ ਇੱਕ ਕੇਟੀਐਮ ਬਾਈਕ ਜਿਹੜੀ ਸਪਲੈਂਡਰ ਬਾਈਕ ਹੈ ਉਹ ਮੇਰੀ ਘਰ ਵਾਸਤੇ ਹੀ ਬਾਈਕ ਘਰ ਦੇ ਕੰਮ ਕਰਨ ਵਾਸਤੇ ਹੀ ਬਾਈਕ ਹੈ ਜਿਹੜੀ ਰੋਇਲ ਇੰਨਫੀਲਡ ਬਾਈਕ ਹੈ ਉਹ ਮੇਰੇ ਟੋਹਰ 'ਚ ਜਾਂ ਸ਼ੋਪਿੰਗ ਘੁੰਮਣ ਘਾਮਣ ਵਾਸਤੇ ਉਹ ਲਈ ਹੋਈ ਹੈ ਜਿਹੜੀ ਮੇਰੀ ਕੇਟੀਐਮ ਬਾਈਕ ਹੈ ਉਹ ਮੇਰੀ ਲੰਬੀ ਲੋਂਗ ਡਰਾਈਵ ਲੰਬੀ ਰਾਈਡਾਂ ਵਾਸਤੇ ਅਤੇ ਹਿੱਲ ਸਟੇਸ਼ਨ ਵਾਸਤੇ ਉਹ ਮੈਂ ਲੈ ਰੱਖੀ ਹੈ ਜਿਹੜੀ ਕਿ ਮੇਰੀ ਕੇਟੀਐਮ ਬਾਈਕ ਹੈ ਉਹ ਉਸਨੂੰ ਲੈ ਕੇ ਮੈਂ ਹਿਮਾਚਲ ਘੁੰਮਣ ਚਲੇ ਜਾਂਦਾ ਹਾਂ ਜਿਸ ਨੂੰ ਦੇਖ ਕੇ ਲੋਕ ਬਹੁਤ ਪ੍ਰਭਾਵਿਤ ਹੁੰਦੇ ਹਨ ਅਤੇ ਮੇਰੇ ਨਾਲ ਆ ਕੇ ਫੋਟੋਆਂ ਖਿਚਵਾਉਂਦੇ ਹਨ

ਫੋਟੋਆਂ ਖਿਚਵਾਉਂਦੇ ਹਨ ਅਤੇ ਮੇਰੇ ਉਸ ਬਾਈਕ ਦੀ ਰਾਈਡ ਵੀ ਮੰਗਦੇ ਹਨ ਅਤੇ ਮੈਂ ਉਹਨਾਂ ਨਾਲ ਮਿਲ ਕੇ ਬਹੁਤ ਖੁਸ਼ ਹੁੰਦਾ ਹਾਂ ਮੈਂ ਇਸ ਬਾਈਕ ਨੂੰ ਲੈ ਕੇ ਜੰਮੂ ਕਸ਼ਮੀਰ ਰਾਜਸਥਾਨ ਅਤੇ ਹੋਰ ਕਈ ਸਟੇਟ 'ਤੇ ਚਲਿਆ ਗਿਆ ਹਾਂ ਉਹਨੇ ਮੈਂ ਹਾਰਲੇ ਡਾਈਵਰਟਸ ਵਾਲੀ ਬਾਈਕ ਵੀ ਬੁੱਕ ਕਰਵਾਈ ਹੋਈ ਹੈ ਜੋ ਮੇਰੀ ਅਗਸਤ ਮਹੀਨੇ ਦੇ ਵਿੱਚ ਆ ਜਾਵੇਗੀ